ਮੈਂ ਆਪਣੇ ਇੱਕ ਸਰ ਨੂੰ ਜਾਣਦਾ ਹਾਂ ਜਿਹਨਾਂ ਕੋਲ ਕਾਲਜ ਦੀ ਡਿਗਰੀ ਉਹਨਾਂ ਤੋਂ ਬਹੁਤ ਸਾਰੀਆਂ ਡਿਗਰੀਜ਼ ਹੈਗੀਆਂ ਜਿਵੇਂ ਕਿ ਬੀ ਬੀ ਐਸ ਸੀ ਇੰਨ ਫਿਜਿਕਸ ਕਮਿਸਟਰੀ ਐਕ ਸੈਕਟਰਾ ਮੈਥਸ ਵੀ ਹੈਗੀ ਉਹਨਾਂ ਤੋਂ ਮਤਲਬ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀਗੇ ਜਦੋਂ ਮੈਂ ਪਲੱਸ ਟੂ ਦੇ ਵਿੱਚ ਸੀਗਾ ਅਤੇ ਫੇਰ ਉਹਦੇ ਬਾਅਦ ਜਿਵੇਂ ਕਿ ਉਹ ਉਹਨਾਂ ਨੂੰ ਮਤਲਬ ਹਰ ਇੱਕ ਫੀਲਡ ਦੀ ਉਹਨਾਂ ਨੂੰ ਹਰ ਇੱਕ ਫੀਲਡ ਦੀ ਨੌਲੇਜ ਹੈ ਉਹਨਾਂ ਕੋਲ ਮੈਂ ਜਾਵਾਂ ਤਾਂ ਉਹਨਾਂ ਨੂੰ ਮੈਂ ਕ ਕੋਈ ਪੁੱਛਣਾ ਹੋਵਾ ਕਿ ਸਰ ਕਿ ਇਹ ਕੰਮ ਇੱਦਾਂ ਕਿਵੇਂ ਹੋਇਆ ਜਾਂ ਫੇਰ ਮੈਂ ਫਿਜੀਕਸ ਸਮਝਣੀ ਹੋਵੇ ਜਾਂ ਕਮਿਸਟਰੀ ਸਮਝਣੀ ਹੋਵੇ ਤਾਂ ਉਹ ਮੈਨੂੰ ਸਾਰੀਆਂ ਚੀਜ਼ਾਂ ਹੀ ਸਮਝਾ ਦਿੰਦੇ ਆ ਲਗਭਗ ਅਤੇ ਜਿੱਦਾਂ ਹੁਣ ਮੇਰਾ ਮੈਥਸ ਮੈਥਸ ਦਾ ਪੇਪਰ ਸੀਗਾ ਤਾਂ ਉਹਨਾਂ ਨੂੰ ਮੈਥਸ ਵੀ ਆਉਂਦਾ ਸੀਗਾ ਅਤੇ ਉਹਨਾਂ ਨੇ ਮੈਥਸ ਵੀ ਮੈਨੂੰ ਦੱਸਤਾ ਕਿ ਇੱਥੇ ਆਹ ਫੋਰਮੂਲਾ ਲੱਗਣਾ ਇੱਥੇ ਆਹ ਫੋਰਮੂਲਾ ਲੱਗਣਾ